ਮੈਨੂੰ ਖੇਡਾਂ ਖੇਡਣਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਖੇਡਾਂ ਦੇਖਣਾ ਵੀ ਕਿਉਂਕਿ ਮੇਰੇ ਸ਼ੁਰੂ ਤੋਂ ਬਹੁਤ ਜ਼ਿਆਦਾ ਮਨਪਸੰਦ ਰਹੀਆਂ ਖੇਡਾਂ ਖੇਡਣਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਖੇਡਾਂ ਦੇ ਵਿੱਚ ਕਾਫੀ ਭਾਗ ਲਿੱਤਾ ਅਤੇ ਮੈਨੂੰ ਖੇਡਣਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਮਤਲਬ ਜਿਹੜੀ ਹੁਣ ਖੇਡਾਂ ਚੱਲਦੀਆਂ ਨੇ ਉਹਨਾਂ ਲਈ ਮਤਲਬ ਕਿ ਮੈਂ ਮੈਚ ਦੇਖਦੀ ਹਾਂ ਜਿਹੜਾ ਵੀ ਉੱਥੇ ਮੈਚ ਹੁੰਦਾ ਜਿਹੜਾ ਵੀ ਮੁਕਾਬਲਾ ਹੁੰਦਾ ਆ ਕਬੱਡੀ ਦਾ ਕ੍ਰਿਕਟ ਦਾ ਫੁੱਟਬਾਲ ਦਾ ਹਾਕੀ ਦਾ ਇਹ ਮੈਂ ਆਪਣਾ ਘਰ ਅਸੀਂ ਸਾਰੇ ਪਰਿਵਾਰਕ ਜੀਅ ਰਲ ਮਿਲ ਕੇ ਟੀ ਵੀ 'ਤੇ ਪ੍ਰੋ ਮੈਚ ਵਗੈਰਾ ਦੇਖਦੇ ਹਾਂ ਅਤੇ ਜਿਹੜੇ ਸਾਡੇ ਘਰ ਅਖਬਾਰ ਲੱਗਾ ਹੋਇਆ ਉਹਦੇ ਵਿੱਚ ਵੀ ਇੱਕ ਪੇ ਸਫਾ ਇੱਦਾਂ ਦਾ ਹੁੰਦਾ ਆ ਜਿਸ 'ਤੇ ਸਾਰੀ ਖੇਡਾਂ ਦੇ ਬਾਰੇ ਜਾਣਕਾਰੀ ਹੁੰ ਜਾਣਕਾਰੀ ਲਿਖੀ ਹੁੰਦੀ ਹੈ ਕਿ ਇਹ ਖੇਡ ਵਿੱਚ ਕੀ ਹੋਇਆ ਕਿਸ ਕਿਹੜੇ ਖਿਡਾਰੀ ਨੇ ਕਿੰਨੇ ਰਨ ਬਣਾਏ ਕਿਹੜਾ ਜਿੱਤਿਆ ਅਤੇ ਕਿਹੜੇ ਪ੍ਰਸ ਖਿਡਾਰੀ ਨੂੰ ਕੀ ਇਨਾਮ ਮਿਲਿਆ ਅਤੇ ਮੈਂ ਯੂਟੀਊਬ 'ਤੇ ਵੀ ਇੱਕ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਆ ਜਿਹਦੇ 'ਤੇ ਮੈਨੂੰ ਸਾਰੀ ਖਬਰਾਂ ਮਿਲਦੀਆਂ ਨੇ ਅਪ ਟੂ ਡੇਟ ਮਤਲਬ ਕਿ ਮੇਰੇ ਫੋਨ 'ਤੇ ਮਤਲਬ ਮੈਨੂੰ ਨੋਟੀਫਿਕੇਸ਼ਨ ਵਗੈਰਾ ਆ ਜਾਂਦਾ ਜਿਸ ਨਾਲ ਮੈਂ ਉਹਨੂੰ ਨੋਟੀਫਿਕੇਸ਼ਨ ਨੂੰ ਖੋਲ੍ਹ ਕੇ ਨਾਲ ਦੀ ਨਾਲ ਮੈਂ ਸਾਰਾ ਕੁਛ ਦੇਖ ਲੈਂਦੀ ਹਾਂ ਕਿ ਆਖਰ ਖੇਡ ਪੱਧਰ ਦੇ ਵਿੱਚ ਜਾਂ ਖੇਡ ਖੇਤਰ ਦੇ ਵਿੱਚ ਕੀ ਚੱਲ ਰਿਹਾ ਹੈ ਅਤੇ ਮੈਂ ਕਾਫੀ ਤਰ੍ਹਾਂ ਦੀ ਖੇਡਾਂ ਖੇਡਦੀ ਹਾਂ ਅਤੇ ਉਹਨਾਂ ਖੇਡਾਂ ਦੇ ਵਿੱਚ ਮੇਰੀ ਸਭ ਤੋਂ ਮਨਪਸੰਦ ਖੇਡ ਹੈ ਚਿੜੀ ਛਿੱਕਾ ਇਹਦ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਨਿਯਮ ਬਣੇ ਹੁੰਦੇ ਹਨ ਪਰ ਜਦੋਂ ਅਸੀਂ ਘਰ ਖੇਡਦੇ ਹਾਂ ਤਾਂ ਮੈਂ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੀ ਬਸ ਅਸ ਅਸੀਂ ਜਦੋਂ ਖੇਡਦੇ ਹਾਂ ਤਾਂ ਅਸੀਂ ਇਹ ਪਹਿਲਾਂ ਧਾਰਨਾ ਬਣਾਉਂਦੇ ਹਾਂ ਕਿ ਖੇਡ ਕਿਸ ਤਰੀਕੇ ਦੀ ਹੋਵੇਗੀ ਮਤਲਬ ਕਿ ਅਸੀਂ ਕਿਹੜੀ ਸਪੀਡ ਦੇ ਵਿੱਚ ਕਿਹੜੇ ਲਹਿਜ਼ੇ ਦੇ ਵਿੱਚ ਖੇਡ ਨੂੰ ਖੇਡਣਾ ਆ ਜਿਵੇਂ ਕਿ ਅਸੀਂ ਹੌਲੀ ਹੌਲੀ ਹੌਲੀ ਖੇਡਣਾ ਤਾਂ ਅਸੀਂ ਹੌਲੀ ਹੌਲੀ ਖੇਡਦੇ ਹਾਂ ਜੇ ਅਸੀਂ ਤੇਜ਼ ਖੇਡਣਾ ਹੁੰਦਾ ਤਾਂ ਅਸੀਂ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਖੇਡਦੇ ਹਾਂ ਅਤੇ ਸਾਡੇ ਘਰ ਜਿਵੇਂ ਗੀਟੇ ਵਗੈਰਾ ਪੀਚੋ ਵਗੈਰਾ ਜਿਹੜੀ ਪੁਰਾਣੀਆਂ ਖੇਡਾਂ ਨੇ ਉਹ ਖੇਡਾਂ ਜ਼ਿਆਦਾ ਪਸੰਦ ਕਰਦੇ ਹਾਂ ਕੈਰਮ ਬੋਰਡ ਵਗੈਰਾ ਹੋ ਗਿਆ ਆਪਣਾ ਕ੍ਰਿਕੇਟ ਵਗੈਰਾ ਹੋ ਗਿਆ ਅਤੇ ਮੈਂ ਇੰਨਾ ਕਾਫੀ ਖੇ ਖੇਡਾਂ ਦੇ ਹੋਰਾਂ ਆਪਣਾ ਜਿਹੜੇ ਨਿਯਮ ਨੇ ਉਹ ਦੱਸਦੀ ਹਾਂ ਅਤੇ ਆਪ ਵੀ ਉਹਨਾਂ ਦੀ ਪਾਲਣਾ ਕਰਦੀ ਹਾਂ